ਤਿੰਨ ਜੁਲਾਈ ਦੋ ਜੀਰੋ ਜੀਰੋ ਤਿੰਨ ਦੋ ਜੁਲਾਈ ਦੋ ਜੀਰੋ ਜੀਰੋ ਚਾਰ ਇਕ ਚਾਰ ਮਈ ਦੋ ਜੀਰੋ ਇਕ ਜੀਰੋ ਪੰਜ ਅਪ੍ਰੈਲ ਦੋ ਜੀਰੋ ਜੀਰੋ ਤਿੰਨ ਛੇ ਅਪ੍ਰੈਲ ਦੋ ਜੀਰੋ ਜੀਰੋ ਦੋ